ਵੈਸੇ ਤਾਂ ਮੈਂ ਕਦੇ ਬਹੁਤ ਜ਼ਿਆਦਾ ਲੋਕਾਂ ਲਈ ਖਾਣਾ ਨਹੀਂ ਬਣਾਇਆ ਪਰ ਲੇਕਿਨ ਲਾਸਟ ਟਾਈਮ ਦੀ ਗੱਲ ਕਰਾਂ ਤਾਂ ਸਾਡੇ ਸਕੂ ਸਕੂਲ ਤੋਂ ਇੱਕ ਟਰਿੱਪ ਗਿਆ ਸੀ ਜੋ ਕਿ ਪਹਾੜ 'ਤੇ ਜਾਣਾ ਸੀਗਾ ਅਸੀਂ ਉੱਥੇ ਗਏ ਪਰ ਉੱਥੇ ਜੋ ਖਾਣਾ ਬਣਾਉਣ ਵਾਲਾ ਸੀਗਾ ਉਹ ਨਹੀਂ ਆਇਆ ਸੀ ਕਿਸੇ ਕਾਰਨ ਤਾਂ ਫਿਰ ਸਾਡੇ ਟੀਚਰ ਨੇ ਪੁੱਛਿਆ ਕਿ ਤੁਹਾਡੇ 'ਚੋਂ ਕੌਣ ਹੈ ਜੋ ਖਾਣਾ ਬਣਾ ਸਕਦਾ ਜਿਸ ਨੂੰ ਆਉਂਦਾ ਆ ਤਾਂ ਮੈਂ ਅਤੇ ਮੇਰੀ ਇੱਕ ਦੋਸਤ ਸੀ ਜੇ ਅਸੀਂ ਦੋਨਾਂ ਨੇ ਹੱਥ ਖੜ੍ਹਾ ਕੀਤਾ ਕਿ ਹਾਂ ਅਸੀਂ ਬਣਾ ਸਕਦੇ ਸਾਨੂੰ ਬਣਾਉਣਾ ਆਉਂਦਾ ਤਾਂ ਫਿਰ ਅਸੀਂ ਦੋਨਾਂ ਨੇ ਮਿਲ ਕੇ ਖਾਣਾ ਬਣਾਇਆ ਜੋ ਸਾਨੂੰ ਇਲੈਕਟ੍ਰਿਕ ਭੱਠੀਆਂ ਮਿਲੀਆਂ ਸੀ ਉਸ 'ਤੇ ਤਾਂ ਅਸੀਂ ਦਾਲ ਅਤੇ ਮਿਕਸ ਵੈੱਜ ਬਣਾਈ ਕਿਉਂਕਿ ਟਾਈਮ ਵੀ ਸਾਡੇ ਕੋਲ ਘੱਟ ਸੀ ਅਤੇ ਬ ਖਾਣਾ ਵੀ ਪੰਜਾਹ ਸੱਠ ਬੱਚਿਆਂ ਦਾ ਬਣਾਉਣਾ ਸੀ ਅਤੇ ਅਸੀਂ ਟਾਈਮ ਵੀ ਥੋੜ੍ਹਾ ਬਚਾਉਣਾ ਸੀਗਾ ਫਿਰ ਜਲਦੀ ਬਣਾਉਣਾ ਸੀ ਤਾਂ ਅਸੀਂ ਕੁਛ ਇੱਟਾਂ ਨੂੰ ਜੋੜ ਕੇ ਇੱਕ ਪਰ ਚੁੱਲ੍ਹਾ ਬਣਾਇਆ ਉਸ 'ਤੇ ਅਸੀਂ ਚੌਲ ਬਣਾਏ ਅਤੇ ਰੋਟੀ ਬਣਾਈ ਜ ਉਸ ਤੋਂ ਬਾਅਦ ਇਹ ਖਾਣਾ ਸੀ ਜੋ ਬਿਲਕੁਲ ਟਾਈਮ 'ਤੇ ਬਣ ਗਿਆ ਸੀ ਅਤੇ ਸਾਰੇ ਬੱਚਿਆਂ ਨੂੰ ਅਸੀਂ ਫਿਰ ਦਿੱਤਾ ਖਾਣ ਲਈ ਅਤੇ ਸਾਰਿਆਂ ਨੇ ਬਹੁਤ ਤਾਰੀਫ ਕੀਤੀ ਕਿ ਬਹੁਤ ਵਧੀਆ ਬਣਿਆ ਅਤੇ ਖਾਣਾ ਬਹੁਤ ਸਵਾਦ ਬਣਿਆ ਸੀ ਟੀਚਰਸ ਨੂੰ ਵੀ ਸਾਡੇ 'ਤੇ ਬਹੁਤ ਮਾਣ ਹੋਇਆ